ਪੰਜਾਬ ਕਈ ਮੁੱਖ ਵਪਾਰਕ ਰੁਝਾਨਾਂ ਅਤੇ ਵਿਕਾਸ ਦਾ ਗਵਾਹ ਹੈ ਜੋ ਇਸ ਦੇ ਆਰਥਿਕ ਦ੍ਰਿਸ਼ ਨੂੰ ਨਵਾਂ ਰੂਪ ਦੇ ਰਿਹਾ ਹੈ ਟਰੈਵਲ ਏਜੰਸੀ ਸੈਕਟਰ ਘਰੇਲੂ ਅਤੇ ਅੰਤਰਰਾਸ਼ਟਰੀ ਸੈਰ ਸਪਾਟਾ ਵਿੱਚ ਵਾਧੇ ਕਾਰਨ ਅਪਗ੍ਰੇਟ ਕੀਤੇ ਹਵਾਈ ਅੱਡਿਆਂ ਅਤੇ ਬਿਹਤਰ ਕਨੈਕਟਿਵਿਟੀ ਸਮੇਤ ਬਿਹਤਰ ਬੁਨਿਆਦੀ ਢਾਂਚੇ ਦੇ ਕਾਰਨ ਮਜਬੂਤ ਵਿਕਾਸ ਦਾ ਅਨੁਭਵ ਕਰ ਰਿਹਾ ਹੈ ਇਸ ਸੈਕਟਰ ਦੇ ਵਿਸਤਾਰ ਨੂੰ ਰਾਜ ਦੀ ਵਿਭਿੰਨ ਸੱਭਿਆਚਾਰਕ ਵਿਆਸਤ ਅਤੇ ਕੁਦਰਤੀ ਆਰਕਸ਼ਣਾਂ ਦੁਆਰਾ ਸਮਰਥਨ ਪ੍ਰਾਪਤ ਹੈ ਇਸਨੂੰ ਖੇਤਰੀ ਆਰਥਿਕ ਗਤੀਵਿਧੀ ਦਾ ਇੱਕ ਮਹੱਤਵਪੂਰਨ ਚਾਲਕ ਬਣਾਉਂਦੇ ਹੋਏ ਹੈਅਰਵੈਕਸ ਵਿੱਚ ਪੰਜਾਬ ਐਰੋਸਪੇਸ ਨਿਰਮਾਣ ਰੱਖ ਰਖਾਵ ਅਤੇ ਮੁਰੰਮਤ ਸੇਵਾਵਾਂ ਵਿੱਚ ਨਿਵੇਸ਼ ਦੇ ਨਾਲ ਉਦਯੋਗ ਲਈ ਇੱਕ ਵੱਧਦੇ ਹੋਏ ਕੇਂਦਰ ਵਜੋਂ ਉੱਭਰ ਰਿਹਾ ਹੈ ਇਹ ਵਾਧਾ ਗਲੋਬਲ ਐਰੋਸਪੇਸ ਕੰਪਨੀਆਂ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਰਾਜ ਦੇ ਹੁਨਰਵੱਧ ਕਰਮਚਾਰੀਆਂ ਅਤੇ ਰਣਨੀਤਿਕ ਸਰਕਾਰੀ ਪਹਿਲ ਕਦਮੀਆਂ ਦੁਆਰਾ ਅਧਾਰਿਤ ਹੈ ਚਮੜਾ ਕੱਪੜਾ ਉਦਯੋਗ ਦੀ ਪ੍ਰਫੁੱਲਤ ਹੋ ਰਿਹਾ ਹੈ ਪੰਜਾਬ ਚਮੜੇ ਦੇ ਉਤਪਾਦਨ ਵਿੱਚ ਆਪਣੀ ਰਵਾਇਤੀ ਮੁਹਾਰਤ ਦਾ ਲਾਭ ਉਠਾ ਰਿਹਾ ਹੈ ਤਾਂ ਜੋ ਇਸ ਦੇ ਨਿਰਯਾਤ ਦੀ ਗੁਣਵੱਤਾ ਅਤੇ ਮੁਕਾਬਲੇਬਾਜ਼ੀ ਨੂੰ ਵਧਾਇਆ ਜਾ ਸਕੇ ਇਸ ਸੈਕਟਰ ਦੇ ਵਿਕਾਸ ਨੂੰ ਨਿਰਮਾਣ ਟੈਕਨੋਲਜੀ ਵਿੱਚ ਤਰੱਕੀ ਅਤੇ ਉੱਚ ਗੁਣਵੱਤਾ ਵਾਲੇ ਚਮੜੇ ਦੇ ਉਤਪਾਦਾਂ ਦੀ ਵਧੀ ਹੋਈ ਵਿਸ਼ਵ ਵਿਆਪੀ ਮੰਗ ਦੁਆਰਾ ਸਮਰਥਨ ਪ੍ਰਾਪਤ ਹੈ ਇਸ ਤੋਂ ਇਲਾਵਾ ਰਾਜ ਸੂਚਨਾ ਟੈਕਨੋਲਜੀ ਖੇਤੀ ਕਾਰੋਬਾਰ ਅਤੇ ਨਵਿਆਣਯੋਗ ਊਰਜਾ ਖੇਤਰਾਂ ਵਿੱਚ ਵੱਧ ਰਹੀ ਗਤੀਵਿਧੀ ਦੇਖ ਰਿਹਾ ਹੈ ਜੋ ਇਸਦੇ ਆਰਥਿਕ ਆਧਾਰ ਵਿੱਚ ਵਿਭਿੰਨਤਾ ਅਤੇ ਨਵੀਨਤਾ ਵੱਲ ਇੱਕ ਵਿਆਪਕ ਰੁਝਾਣ ਨੂੰ ਦਰਸਾਉਂਦਾ ਹੈ ਇਹ ਵਿਕਾਸ ਸਮੂਹਿਕ ਤੌਰ 'ਤੇ ਪੰਜਾਬ ਦੇ ਉੱਭਰਦੇ ਕਾਰੋਬਾਰੀ ਮਾਹੌਲ ਨੂੰ ਉਜਾਗਰ ਕਰਦੇ ਹਨ ਇਸ ਵਿੱਚ ਬੁਨਿਆਦੀ ਢਾਂਚੇ ਉਦਯੋਗਿਕ ਨਿਵੇਸ਼ ਅਤੇ ਕੁਦਰਤ ਖੇਤਰੀ ਵਿਸਤਾਰ 'ਤੇ ਜੋਰ ਦਿੱਤਾ ਜਾਂਦਾ ਹੈ